ਹੈਲੋ ਜਸਵਿੰਦਰ ਸਿੰਘ ਥੋੜ੍ਹੇ ਸਮੇਂ ਪਹਿਲਾਂ ਮੈਂ ਕੋਲਜ ਰੋਡ ਤੋਂ ਤੁਹਾਡੇ ਕੋਲੋਂ ਚੰਡੀਗੜ੍ਹ ਜਾਣ ਲਈ ਓਲਾ ਕੈਬ ਬੁੱਕ ਕੀਤੀ ਸੀ ਪਰ ਪਰ ਕਿਸੇ ਕਾਰਨ ਮੈਨੂੰ ਬਜ਼ਾਰ ਵਿੱਚ ਕੋਈ ਕੰਮ ਪੈ ਗਿਆ ਅਤੇ ਮੈਂ ਹੁਣ ਤੁਹਾਨੂੰ ਬੇ ਕੋਲਿਜ ਰੋਡ ਨਾ ਹੋ ਕੇ ਬੇਲਾ ਚੌਂਕ ਮਿਲਾਂਗੀ ਕਿਰਪਾ ਕਰਕੇ ਮੈਨੂੰ ਉੱਥੇ ਤੋਂ ਪਿੱਕ ਕਰਨ ਦੀ ਕ੍ਰਿਪਾਲਤਾ ਕਰੋ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ